ਮੇਰੀ ਗਾਇਕੀ ਵਿੱਚ ਭਾਵਨਾ ਬਹੁਤ ਜਿਆਦਾ ਭੂਮਿਕਾ ਨਿਭਾਉਂਦੀ ਹੈ ਕਿਉਂਕਿ ਦੇਖੋ ਤੁਸੀਂ ਜਦੋਂ ਵੀ ਕੋਈ ਗਾਣਾ ਸੁਣਦੇ ਹੋ ਤੇ ਭਾਵਨਾ ਦੇ ਹਿਸਾਬ ਨਾਲ ਹੀ ਸੁਣਦੇ ਹੋ ਗਾਣਾ ਟੀ ਵੀ ਤੇ ਆ ਰਿਹਾ ਹੋਏ ਜਾਂ ਫੋਨ ਤੇ ਸੁਣਨਾ ਹੋਏ ਜਾਂ ਕੋਈ ਵੀ ਤੁਸੀਂ ਸਮਾਗਮ ਤੇ ਜਾਓ ਜਾਂ ਗੁਰੂਆਂ ਦੇ ਕੋਲ ਜਾਓ ਜਾ ਕਿਤੇ ਵੀ ਤੁਸੀਂ ਜਿਹੜੀ ਵੀ ਚੀਜ਼ ਤੁਹਾਡੇ ਅੰਦਰ ਲੈ ਵਿੱਚ ਉਤਾਰਨੀ ਹੈ ਭਗਵਾਨ ਦਾ ਨਾਮ ਵੀ ਲੈਣਾ ਤੇ ਤੁਸੀਂ ਗਾਇਕੀ ਦੇ ਨਾਲ ਹੀ ਲੈਂਦੇ ਹੋ ਮੈਂ ਜੇ ਕੋਈ ਇਮੋਸ਼ਨਲ ਗਾਣਾ ਹੈ ਤੇ ਮੈਂ ਮੇਰੇ ਉਹ ਇਮੋਸ਼ਨਲ ਹੀ ਜਦੋਂ ਮੇਰੇ ਮਨ ਜਿੱਦਾਂ ਦਾ ਹੋਏਗਾ ਮੈਂ ਉਸ ਹਿਸਾਬ ਨਾਲ ਹੀ ਗਾਣਾ ਸੁਣਨਾ ਚਾਹਵਾਂਗੀ ਤੇ ਆਪਾਂ ਖੁਸ਼ੀ ਦੇ ਮੌਕੇ 'ਚ ਜਵਾਂਗੇ ਤੇ ਆਪਾਂ ਨੱਚਣ ਟੱਪਣ ਵਾਲਾ ਗਾਣਾ ਸੁਣਦੇ ਆਂ ਤੇ ਸਭ ਬੋਲਦੇ ਆ ਨੱਚਦੇ ਹਾਂ ਭੰਗੜੇ ਪਾਉਂਦੇ ਹਾਂ ਖੁਸ਼ ਹੁੰਦੇ ਹਾਂ ਤੇ ਜਦੋਂ ਅਸੀਂ ਭਗਵਾਨ ਦਾ ਨਾਮ ਲੈਦੇ ਆ ਤੇ ਅਸੀਂ ਭਗਵਾਨ ਦੇ ਨਾਮ ਦੀ ਗਾਈਕ ਕਰਕੇ ਖੁਸ਼ ਹੁੰਦੇ ਹਾਂ ਅਸੀਂ ਗੁਰਦੁਆਰਿਆਂ ਵਿੱਚ ਹੀ ਕਿਤੇ ਵੀ ਦੇਖਿਆ ਹੋਏਗਾ ਅੱਜ ਕੱਲ ਸਾਡੇ ਜੀਵਨ ਵਿੱਚ ਗਾਇਕੀ ਦੀ ਬਹੁਤ ਵੱਡੀ ਭੂਮਿਕਾ ਹੈਗੀ ਕਿਉਂਕਿ ਗਾਇਕੀ ਦਾ ਹਿਸਾਬ ਨਾਲ ਹੀ ਸਾਨੂੰ ਹਰ ਤਰ੍ਹਾਂ ਦਾ ਅਸੀਂ ਜੇ ਖੁਸ਼ ਹਾਂ ਜੇ ਅਸੀਂ ਖੁਸ਼ੀ ਦੇ ਗੀਤ ਗਾਵਾਂਗੇ ਜੇ ਕਿ ਤੁਹਾਡੇ ਘਰ ਵਿਆਹ ਹੈ ਤੇ ਤੁਸੀਂ ਵਿਆਹ ਦੇ ਗੀਤ ਗਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰੋਗੇ ਤੇ ਜੇ ਤੁਸੀਂ ਭਗਵਾਨ ਦਾ ਨਾਮ ਲੈਣਾ ਤੁਸੀਂ ਇੱਕ ਭਜਨ ਕੀਰਤਨ ਕੁਝ ਵੀ ਕਰਕੇ ਰੱਬ ਦਾ ਨਾਮ ਲਉਗੇ ਤੇ ਇਸ ਤਰ੍ਹਾਂ ਤੁਸੀਂ ਆਪਣੀ ਗਾਇਕੀ ਦੇ ਪ੍ਰਦਰਸ਼ਨ ਨੂੰ ਪ੍ਰਗਟ ਕਰੋਗੇ ਕਿ ਤੁਹਾਨੂੰ ਜੋ ਉਹ ਗਾਇਕੀ ਦੁਆਰਾ ਪਤਾ ਲੱਗ ਜਾਏਗਾ ਕਿ ਤੁਸੀਂ ਇਥੇ ਤੇ ਕਿਸੇ ਦੇ ਘਰ ਕੀਰਤਨ ਹੈ ਤੇ ਫਿਰ ਭਗਵਾਨ ਦਾ ਨਾਮ ਵਿਆਹ ਸ਼ਾਦੀ ਹੈ ਤੇ ਨੱਚਣ ਕੱਪਣ ਵਾਲੇ ਗਾਣੇ ਲੱਗਦੇ ਹਨ ਇਸ ਤਰਾਂ ਤੁਸੀਂ ਉਥੋਂ ਜਾਂਚ ਆਓਗੇ ਕਿ ਅੱਜ ਇਹਨਾਂ ਦੇ ਘਰ ਕਿਸੇ ਦੇ ਘਰ ਪਾਠ ਹੈ ਜਾਂ ਕੁਛ ਹੈ ਜਾਂ ਸਾਡੇ ਘਰ ਵਿੱਚ ਵੀ ਕੁਛ ਹੈ ਇਸ ਕਰਕੇ ਅੱਜ ਕੱਲ ਗਾਇਕੀ ਦਾ ਭਾਵਨਾਵਾਂ ਦੇ ਨਾਲ ਬਹੁਤ ਜਿਆਦਾ ਬਹੁਤ ਪ੍ਰਦਰਸ਼ਨ ਗਾਇਕੀ ਦੁਆਰਾ ਹੀ ਅਸੀਂ ਕਰ ਸਕਦੇ ਹਾਂ ਧੰਨਵਾਦ